ਵੈਸੇ ਤਾਂ ਮੇਰੇ ਘਰ ਦੇ ਨੇੜੇ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿੱਥੇ ਅਸੀਂ ਅਕਸਰ ਹੀ ਜਾਂਦੇ ਰਹਿੰਦੇ ਹਾਂ ਪਰ ਮੈਨੂੰ ਸਭ ਤੋਂ ਵੱਧ ਸਾਡੇ ਲਾਗੇ ਗੁਰਦੁਆਰਾ ਹੈ ਗੁਰਦੁਆਰਾ ਟਿੱਬੀ ਸਾਹਿਬ ਉੱਥੇ ਜਾਣਾ ਬਹੁਤ ਪਸੰਦ ਹੈ ਉੱਥੇ ਦਾ ਜਿਹੜਾ ਵਾਤਾਵਰਨ ਹੈ ਬਹੁਤ ਹੀ ਮਨਮੋਹਕ ਹੈ ਉੱਥੇ ਦਾ ਜਿਹੜਾ ਦ੍ਰਿਸ਼ ਦੇਖਣ ਵਾਲਾ ਹੁੰਦਾ ਉਹ ਵੀ ਮਨ ਨੂੰ ਬਹੁਤ ਹੀ ਭਾਉਂਦਾ ਹੈ ਅਤੇ ਜਿਹੜਾ ਉੱਥੇ ਦਾ ਗੁਰਦੁਆਰਾ ਹੈ ਉਹ ਬਹੁਤ ਹੀ ਉਚਾਈ ਦੇ ਉੱਤੇ ਸਥਿਤ ਹੈ ਅਤੇ ਨੇੜੇ ਹੀ ਉਸਦੇ ਸਤਲੁਜ ਦਰਿਆ ਹੈ ਜਿਹੜਾ ਕਿ ਵੱਗਦਾ ਹੈ ਜਿਹੜੇ ਉੱਥੇ ਸੇਵਾਦਾਰ ਨੇ ਚੌਵੀ ਘੰਟੇ ਉੱਥੇ ਸੇਵਾ ਕਰਦੇ ਨੇ ਅਤੇ ਚੌਵੀ ਘੰਟੇ ਉੱਥੇ ਹੈ ਜਿਹੜਾ ਲੰਗਰ ਹੈ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਲੰਗਰ ਹੈ ਵਰਤਾਇਆ ਜਾਂਦਾ ਹੈ ਅਤੇ ਉੱਥੇ ਜਾ ਕੇ ਸੇਵਾ ਕਰਨਾ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਹੈ